ਦਸ ਦਿਨ ਪਹਿਲਾਂ ਮੈਂ ਘਰ ਵਿਹਲੀ ਬੈਠੀ ਸੀ ਤਾਂ ਮੈਨੇ ਕੁਝ ਮੰਗਾਉਣ ਦਾ ਸੋਚਿਆ ਇਸ ਲਈ ਮੈਨੇ ਫਲਿਪਕਾਰਟ ਨਾਮ ਦਾ ਐਪ ਡਾਊਨਲੋਡ ਕੀਤਾ ਉਸ ਉੱਤੇ ਮੈਨੇ ਕੁ ਉਸ ਉੱਤੇ ਮੈਨੇ ਇੱਕ ਡਿਓਡਰੈਂਟ ਮੰਗਾਉਣ ਦਾ ਸੋਚਿਆ ਉਸ ਉੱਤੇ ਬੜੀ ਵਧੀਆ ਅਤੇ ਸਸਤੀ ਸੇਲ ਲੱਗ ਰਹੀ ਸੀ ਉੱਥੇ ਇੱਕ ਨਾਲ ਇੱਕ ਡਿਓਡਰੈਂਟ ਫਰੀ ਸੀ ਜੋ ਕਿ ਬਹੁਤ ਘੱਟ ਰੇਟਾਂ ਵਿੱਚ ਸੀ ਬਜ਼ਾਰ ਨਾਲੋਂ ਵੀ ਸਸਤਾ ਸੀ ਮੈਨੇ ਇਹ ਦ ਔਡਰ ਕਰ ਦਿੱਤਾ ਇਹ ਔਡਰ ਮੈਨੂੰ ਬਹੁਤ ਚੰਗੀ ਅਤੇ ਵਧੀਆ ਸਥਿਤੀ ਵਿੱਚ ਪ੍ਰਾਪਤ ਹੋਇਆ ਇਸ ਦੀ ਪੈਕੇਜਿੰਗ ਬੜੀ ਅੱਛੀ ਸੀ ਅਤੇ ਬੋਟਲਾਂ ਦੋਨੇ ਠੀਕ ਸੀਗੀਆਂ ਇਹ ਇਸ ਦੀ ਪੈਕੇਜਿੰਗ ਵਾਟਰਪਰੂਫ ਸੀ ਇਸ ਦੀ ਖ਼ੁਸ਼ਬੂ ਬੜੀ ਚੰਗੀ ਸੀ ਮੇਰੇ ਘਰਦੇ ਇਹ ਕੁਝ ਦੇਖ ਕੇ ਬੜੇ ਖੁਸ਼ ਹੋਏ ਕਿ ਮੇਨੇ ਘੱਟ ਰੇਟਾਂ ਵਿੱਚ ਦੋ ਪੇਕੇਜਿੰਗ ਮੰਗਵਾ ਲਿੱਤੀ ਇਹ ਮੇਰਾ ਫਸਟ ਔਡਰ ਸੀ ਜੋ ਕਿ ਮੈਨੂੰ ਬੜੇ ਵਧੀਆ ਤਰੀਕੇ ਨਾਲ ਪ੍ਰਾਪਤ ਹੋਇਆ ਇਹ ਦੇਖ ਕੇ ਮੈਂ ਬਹੁਤ ਖੁਸ਼ ਸੀ ਮੈਂ ਅੱਗੇ ਵੀ ਫਲਿਪਕਾਰਟ ਤੋਂਂ ਕੁਛ ਨਾ ਕੁਛ ਔਡਰ ਕਰਦੀ ਰਹਾਂਗੀ ਧੰਨਵਾਦ